ਪੰਜਾਬੀ ਲੋਕ ਵੱਖ ਵੱਖ ਭਾਸ਼ਾ ਦੀ ਜਾਣਕਾਰੀ ਵੀ ਨਾਲ ਰੱਖਦੇ ਨੇ ਜਿਵੇਂ ਹਿੰਦੀ ਅੰਗਰੇਜ਼ੀ ਇਹ ਜਦੋਂ ਦੂਸਰੇ ਖੇਤਰ ਦੇ ਲੋਕਾਂ ਨਾਲ ਗੱਲ ਕਰਦੇ ਨੇ ਤਾਂ ਪੰਜਾਬੀ ਦੇ ਨਾਲ ਨਾਲ ਇਹ ਹਿੰਦੀ ਬੋਲ ਕੇ ਵੀ ਦੂਸਰੇ ਨੂੰ ਆਪਣੇ ਸ਼ਬਦ ਸਮਝਾਉਣ ਦਾ ਯਤਨ ਕਰਦੇ ਨੇ ਜੇਕਰ ਕੋਈ ਸ਼ਬਦ ਇਹਨਾਂ ਨੂੰ ਅੰਗਰੇਜ਼ੀ ਵਿੱਚ ਵੀ ਬੋਲਣਾ ਪਵੇ ਤਾਂ ਇਹ ਉਹ ਸ਼ਬਦ ਬੜਾ ਵਧੀਆ ਬੋਲ ਲੈਂਦੇ ਨੇ ਆਪਣੀ ਗੱਲ ਉਸਨੂੰ ਵਧੀਆ ਤਰੀਕੇ ਨਾਲ ਸਮਝਾਉਂਦੇ ਨੇ ਪੰਜਾਬੀ ਜਿਹੜੇ ਨੇ ਇਹ ਆਪਣੇ ਸੁਭਾਅ ਕਰਕੇ ਵਧੀਆ ਜਾਣੇ ਜਾਂਦੇ ਨੇ ਇਸ ਕਰਕੇ ਜਦੋਂ ਇਹ ਦੂਸਰਿਆਂ ਨਾਲ ਗੱਲ ਕਰਦੇ ਨੇ ਤਾਂ ਇਹ ਉਸ ਨੂੰ ਆਪਣੀ ਗੱਲ ਸਮਝਾਉਣ ਲਈ ਹਰੇਕ ਤਰੀਕੇ ਦਾ ਯਤਨ ਕਰਕੇ ਉਸ ਨੂੰ ਆਪਣੀ ਗੱਲ ਸਮਝਾਉਂਦੇ ਨੇ ਪੰਜਾਬੀ ਜਿਹੜੇ ਨੇ ਇਹ ਪੰਜਾਬੀ ਦੇ ਨਾਲ ਨਾਲ ਹਿੰਦੀ ਅੰਗਰੇਜ਼ੀ ਦੀ ਵਰਤੋਂ ਕਰ ਲੈਂਦੇ ਨੇ ਅਤੇ ਜਿਸ ਵੀ ਖੇਤਰ ਵਿੱਚ ਜਾਂਦੇ ਨੇ ਉੱਥੋਂ ਦੇ ਸ਼ਬਦ ਜਲਦੀ ਸਿੱਖ ਜਾਂਦੇ ਨੇ ਇਸ ਕਰਕੇ ਇਹ ਹਰੇਕ ਜੀਵ ਨੂੰ ਆਪਣੀ ਗੱਲ ਸਮਝਾਉਣ ਵਾਸਤੇ ਬੜੇ ਹੀ ਸਲੀਕੇ ਦੇ ਨਾਲ ਵੱਖ ਵੱਖ ਭਾਸ਼ਾ ਦੀ ਵਰਤੋਂ ਕਰ ਲੈਂਦੇ ਨੇ